ਅੰਤਰਪਨੋਰਸ਼ਿਪ ਦਾ ਮਤਲਬ ਹੁੰਦਾ ਹੈ ਆਪਣੇ ਬਿਜ਼ਨੇਸ ਆਈਡਿਆ ਨੂੰ ਕਾਰੋਬਾਰ ਵਿੱਚ ਬਦਲਣਾ ਬਿਨਾਂ ਕਿਸੀ ਬੰਦਿਸ਼ ਤੋਂ ਜਿਸ ਵਿੱਚ ਅਸੀਂ ਨਵੀਂ ਤਕਨੀਕ 'ਤੇ ਅਵਿਸ਼ਕਾਰਾਂ ਨੂੰ ਮਾਰਕੀਟ ਵਿੱਚ ਲਿਆ ਕੇ ਆਪਣੇ ਅਕੋਡਿੰਗ ਕਾਰੋਬਾਰ ਦੀ ਸਥਾਪਨਾ ਕਰਦੇ ਹਾਂ ਬਿਨਾਂ ਕਿਸੀ ਸਖਤੀ 'ਤੇ ਬੰਦਿਸ਼ 'ਤੇ ਪੰਜਾਬ ਵਿੱਚ ਅੰਤਰਪਨੋਰਸ਼ਿਪ ਨੂੰ ਬਹੁਤ ਉਤਸ਼ਾਹਿਤ ਕੀਤਾ ਗਿਆ ਹੈ ਪੰਜਾਬ ਦਾ ਯੁਵਾ ਇਸ ਵਿੱਚ ਬਹੁਤ ਵੱਧ ਚੜ੍ਹ ਕੇ ਭਾਗ ਲੈਂਦਾ ਹੈ ਯੁਵਾਵਾਂ ਦੇ ਵਿਚਾਰ ਇੱਕ ਸਫ਼ਲ ਕਾਰੋਬਾਰ ਸਥਾਪਿਤ ਕਰਨ ਦੀ ਸਮਰਥ ਰੱਖਦਾ ਹੈ ਪੰਜਾਬ ਸਰਕਾਰ ਵੀ ਅੰਤਰਪਨੋਰਸ਼ਿਪ ਨੂੰ ਪ੍ਰਮੋਟ ਕਰ ਰਿਹਾ ਹੈ ਸਰਕਾਰ ਅਲੱਗ ਅਲੱਗ ਸਕੀਮਾਂ ਅਤੇ ਯੋਜਨਾਵਾਂ ਚਲਾ ਕੇ ਫੰਡਿੰਗ ਦੇ ਰਹੇ ਹਨ ਇਸ ਵਿੱਚ ਕਰੀਏਟਿਵ ਡਿਜਿਸਨ ਮੈਕਿੰਗ ਹੁੰਦੀ ਹੈ ਇਸ ਵਿੱਚ ਪ੍ਰੋਡਕਟ ਦੀ ਬਣਾਵਟ 'ਤੇ ਸਟਰਗਲਿੰਗ ਬਾਰੇ ਡਸੀਜਨ ਲਿਆ ਜਾਂਦਾ ਹੈ ਅੰਤਰਪਨੋਰਸ਼ਿਪ ਵਿੱਚ ਨਵੇਂ ਨਵੇਂ ਆਈਡੀਆ ਨੂੰ ਮਾਰਕੀਟ ਵਿੱਚ ਲਿਆਇਆ ਜਾਂਦਾ ਹੈ ਇਸ ਨਾਲ ਦੇਸ਼ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ ਇਸ ਨਾਲ ਨੌਕਰੀਆਂ ਵੀ ਵਧਦੀਆਂ ਹਨ ਧੰਨਵਾਦ